ਸਾਡੇ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਬਹੁਤ ਕੁਝ ਕਰ ਸਾਰੇ ਕਦਮ ਉਠਾਉਂਦੇ ਹਨ ਸਾਡੇ ਪਿੰਡ ਵਿੱਚ ਸਰਕਾਰੀ ਡਿਸਪੈਸਰੀ ਹੈ ਉੱਥੇ ਹੀ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਟੀਕਾ ਲਗਵਾਉਂਦੇ ਹਨ ਅਤੇ ਬੂੰਦਾਂ ਵੀ ਪਿਲਾਉਂਦੇ ਹਨ ਉਹ ਆਪਣੇ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਦੀ ਜਾਣਕਾਰੀ ਵੀ ਦਿੰਦੇ ਹਨ ਤਾਂ ਜੋ ਉਹ ਸਮਝ ਸਕਣ ਪੋਲੀਓ ਦੇ ਬਚਾਅ ਲਈ ਟੀਕੇ ਅਤੇ ਦਵਾਈ ਲੈਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਸਭ ਲੋਕ ਇਹ ਸਭ ਕੁਝ ਕਰਦੇ ਹਨ ਧੰਨਵਾਦ ਜੀ